ਹੈਲੋ ਸਤਿ ਸ਼੍ਰੀ ਅਕਾਲ ਸਰ ਮੈਂ ਪਠਾਨਕੋਟ ਤੋਂ ਸੁਰਜੀਤ ਬੋਲਦਾ ਹਾਂ ਜੋ ਕਿ ਮੈਂ ਤੁਹਾਡੇ ਕੋਲੋਂ ਇੱਕ ਪ੍ਰੋਡੈਕਟ ਜੋ ਕਿ ਹੀਟਰ ਮੰਗਵਾਇਆ ਸੀ ਇਸ ਦਾ ਆਰਡਰ ਤਿੰਨ ਦਿਨ ਵਿੱਚ ਘਰ ਪੁੱਜਣ ਦਾ ਸੀ ਜੋ ਕਿ ਮੈਨੂੰ ਪੰਜ ਦਿਨ ਬਾਅਦ ਮੈਨੂੰ ਘਰ ਮਿਲਿਆ ਉਹ ਇਸ ਤਰ੍ਹਾਂ ਕਿ ਜਦੋਂ ਮੈਂ ਉਸਦੀ ਪੈਕਿੰਗ ਖੋਲ੍ਹੀ ਤਾਂ ਮੈਨੂੰ ਪਤਾ ਸੀ ਕਿ ਇਹ ਤਿੰਨ ਦਿਨ ਵਿੱਚ ਮੇਰੇ ਘਰ ਪੁੱਜਣਾ ਸੀ ਜੋ ਕਿ ਪੰਜ ਦਿਨਾਂ ਬਾਅਦ ਮੇਰੇ ਘਰ ਪਹੁੰਚਿਆ ਲੇਕਿਨ ਮੈਨੂੰ ਇਸ ਤੋਂ ਕੋਈ ਵੀ ਸ਼ਿਕਾਇਤ ਨਹੀਂ ਸੀ ਜੋ ਕਿ ਜਿਹੜੀ ਚੀਜ਼ ਮੈਨੂੰ ਚਾਹੀਦੀ ਸੀ ਇੱਕ ਦਿਨ ਕੀ ਦੋ ਦਿਨ ਲੇਟ ਹੋ ਪਹੁੰਚੀ ਕੋਈ ਫ਼ਰਕ ਨਹੀਂ ਲੇਕਿਨ ਜੋ ਸਮਾਨ ਮੇਰੇ ਘਰ ਪਹੁੰਚਿਆ ਲੇਕਿਨ ਉਹ ਸਮਾਨ ਤਾਂ ਸਹੀ ਹੋਣਾ ਚਾਹੀਦਾ ਸੀ ਜੋ ਜਦੋਂ ਕਿ ਮੈਂ ਉਸ ਹੀਟਰ ਨੂੰ ਆਪਣੇ ਰੂਮ ਵਿੱਚ ਲਗਾਇਆ ਜੋ ਕਿ ਠੰਡ ਦਾ ਮੌਸਮ ਸੀ ਰਾਤ ਦੇ ਵਕਤ ਜਿੱਦਾਂ ਹੀ ਮੈਨੇ ਉਹ ਹੀਟਰ ਦੀ ਪੈਕਿੰਗ ਖੋਲ੍ਹੀ ਜਦੋਂ ਮੈਂ ਹੀਟਰ ਲਗਾਉਣਾ ਸ਼ੁਰੂ ਕੀਤਾ ਤਾਂ ਉਸ ਦੀਆਂ ਜੋ ਕਿ ਪੰਜ ਰਾਡਾ ਸੀ ਉਹਨਾਂ ਵਿੱਚੋਂ ਤਿੰਨ ਰਾਡਾ ਹੀਟ ਕਰ ਰਹੀਆਂ ਸਨ ਦੋ ਰਾਡਾਂ ਆਲਰੇਡੀ ਬੰਦ ਸੀ ਜੋ ਕਿ ਦੇਖ ਕੇ ਮੈਨੂੰ ਬੜਾ ਹੀ ਮਾੜਾ ਲੱਗਿਆ ਕਿ ਮੇਰੇ ਪੰਦਰਾਂ ਸੌ ਰੁਪਏ ਖਰਚਣ ਨਾਲ ਮੈਨੂੰ ਮੇਰੀ ਚੀਜ਼ ਮੇਰੇ ਮਨ ਪਸੰਦ ਨਹੀਂ ਮਿਲੀ ਜੋ ਕਿ ਮੈਂ ਚਾਹੁੰਦਾ ਹਾਂ ਕਿ ਇਹ ਹੀਟਰ ਵਾਪਿਸ ਕੀਤਾ ਜਾਵੇ ਜੋ ਕਿ ਮੈਂ ਇਸ ਦੀ ਥਾਂ ਕੋਈ ਹੋਰ ਹੀਟਰ ਲੈ ਸਕਾਂ ਹੋ ਸਕੇ ਤਾਂ ਮੈਨੂੰ ਨਿਆ ਹੀਟਰ ਦਿੱਤਾ ਜਾਵੇ ਨਹੀਂ ਤਾਂ ਮੈਨੂੰ ਮੇਰਾ ਪੈਸਾ ਵਾਪਿਸ ਦਿੱਤਾ ਜਾਵੇ ਜੋ ਕਿ ਮੈਂ ਹੋਰ ਨਿਆ ਹੀਟਰ ਲੈ ਸਕਾਂ